ਹਾਂਜੀ ਦੋਸਤੋ ਪਕਵਾਨ ਖਾਣੇ ਸਭ ਨੂੰ ਪਸੰਦ ਹੁੰਦੇ ਹਨ ਲੇਕਿਨ ਉਹਨਾਂ ਨੂੰ ਬਣਾ ਕੋਈ ਕੋਈ ਹੀ ਸਕਦਾ ਹੈ ਅਤੇ ਉਹ ਬਣਾਉਣੇ ਵੀ ਕਿਸੇ ਕਿਸੇ ਨੂੰ ਹੀ ਪਸੰਦ ਹੁੰਦੇ ਹਨ ਲੇਕਿਨ ਮੈਨੂੰ ਪਕਵਾਨ ਬਣਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਅਤੇ ਜਦੋਂ ਅਸੀਂ ਆਪਣਾ ਪਕਵਾਨ ਜਿਹੜਾ ਬਣਾਇਆ ਹੈ ਔਰ ਉਹ ਬਣਨ ਦੇ ਵਿੱਚ ਸਵਾਦਿਸ਼ਟ ਬਣੇ ਫਿਰ ਤਾਂ ਬਸ ਸਾਡੇ ਜਿਹੜਾ ਹੈਗਾ ਅਨੰਦ ਦੀ ਕੋਈ ਸੀਮਾ ਹੀ ਨਹੀਂ ਰਹਿੰਦੀ ਅਤੇ ਜਦੋ ਅਸੀਂ ਆਪਣਾ ਪਕਵਾਨ ਜਿਹੜਾ ਹੈ ਬਣਾਇਆ ਹੋਇਆ ਕਿਸੇ ਨੂੰ ਅਸੀਂ ਪੇਸ਼ ਕਰਦੇ ਹਾਂ ਕਿਸੇ ਨੂੰ ਖਿਲਾਂਦੇ ਹਾਂ ਤਾਂ ਜਦੋਂ ਸਾਹਮਣੇ ਵਾਲਾ ਖਾ ਕੇ ਸਾਡੇ ਪਕਵਾਨ ਦੀ ਤਾਰੀਫ਼ ਕਰਦਾ ਹੈ ਤਾਂ ਬਸ ਫਿਰ ਤਾਂ ਸਾਡੇ ਜਿਹੜਾ ਹੈ ਸਾਡੀ ਖੁਸ਼ੀ ਦੀ ਕੋਈ ਸੀਮਾ ਨਹੀਂ ਰਹਿੰਦੀ ਅਤੇ ਫਿਰ ਜਦੋਂ ਸਾਹਮਣੇ ਵਾਲਾ ਪੁੱਛ ਲਵੇ ਕਿ ਹਾਂਜੀ ਮੈਮ ਤੁਸੀਂ ਇਹ ਪਕਵਾਨ ਕਿਵੇਂ ਬਣਾਇਆ ਹੈ ਸਾਨੂੰ ਵੀ ਜ਼ਰਾ ਇਸਦਾ ਰਾਜ਼ ਦੱਸੋ ਕਿ ਅਸੀਂ ਵੀ ਇਸਨੂੰ ਬਣਾਈਏ ਉਸ ਤਰੀਕੇ ਨਾਲ ਤਾਂ ਕਿ ਅਸੀਂ ਵੀ ਆਪਣੇ ਘਰ ਬਣਾ ਸਕੀਏ ਇਸਦਾ ਬਣਾ ਕੇ ਇਸਦਾ ਰੋਜ਼ ਰੋਜ਼ ਆਨੰਦ ਉਠਾ ਸਕੀਏ ਫਿਰ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਫਿਰ ਅਸੀਂ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਆਪਣਾ ਪਕਵਾਨ ਜਿਹੜਾ ਹੈਗਾ ਹੈ ਬਣਾਉਣ ਦੇ ਵਿ ਵਿੱਚ ਪਹਿਲਾਂ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਹੁੰਦੀ ਹੈ ਸਾਨੂੰ ਜਿਹੜੀ ਜਿਹੜੀ ਉਹਦੇ ਵਿੱਚ ਸਮੱਗਰੀ ਜਿਹੜੀ ਯੂਜ਼ ਹੋਣੀ ਹੁੰਦੀ ਹੈ ਉਹ ਸਾਡੇ ਕੋਲ ਪਹਿਲੇ ਹੋਣੀ ਚਾਹੀਦੀ ਹੈ ਅਤੇ ਅਸੀਂ ਸਮੱਗਰੀ ਜਿਹੜੀ ਹੈਗੀ ਹੈ ਹੁਣ ਅਸੀਂ ਪਕਵਾਨ ਨੂੰ ਬਣਾਉਣ ਵਾਸਤੇ ਜਿਹੜੀ ਅਸੀਂ ਵਰਤ ਰਹੇ ਹਾਂ ਤਾਂ ਉਸਦੀ ਜਿਹੜੀ ਹੈਗੀ ਹੈ ਸਹੀ ਜਿਹੜੀ ਹੈਗੀ ਆ ਰੇਸ਼ੋ ਮਤਲਬ ਅਮਾਉਂਟ ਕਿੰਨੀ ਯੂਜ਼ ਕਰ ਰਹੇ ਹਾਂ ਸਭ ਤੋਂ ਏ ਇਹ ਵੀ ਇੱਕ ਪੁਆਇੰਟ ਹੈ ਕਿ ਤੁਸੀਂ ਕਿੰਨੀ ਰੇਸ਼ੋ ਦੇ ਵਿੱਚ ਅਮਾਉਂਟ ਦੇ ਵਿੱਚ ਉਹ ਸਮੱਗਰੀ ਲੈ ਰਹੇ ਹੋ ਅਗਰ ਤੁਸੀਂ ਕਿਸੇ ਚੀਜ਼ ਨੂੰ ਪਕਵਾਨ ਨੂੰ ਬਣਾਉਣ ਟਾਈਮ ਤੁਹਾਡੀ ਜਿਹੜੀ ਇਹ ਸਮੱਗਰੀ ਦੀ ਜਿਹੜੀ ਰੇਸ਼ੋ ਹੈ ਇਹ ਉੱਪਰ ਨੀਚੇ ਹੋ ਜਾਂਦੀ ਹੈ ਤਾਂ ਜਿਹੜਾ ਤੁਹਾਡਾ ਉਹ ਪਕਵਾਨ ਹੈ ਉਹ ਬਿਲਕੁਲ ਵੀ ਮਤਲਬ ਉਸ ਤਰ੍ਹਾਂ ਦਾ ਨਹੀਂ ਬਣੇਗਾ ਜਿਸ ਤਰ੍ਹਾਂ ਦਾ ਕਿ ਉਹ ਬਣਨਾ ਚਾਹੀਦਾ ਹੈ ਮਤਲਬ ਉਹ ਸੁਆਦਿਸ਼ਟ ਨਹੀਂ ਬਣੇਗਾ ਇਸ ਕਰਕੇ ਇਹਨਾਂ ਚੀਜ਼ਾ ਦਾ ਅਸੀਂ ਉਹਨਾਂ ਨੂੰ ਸਾਹਮਣੇ ਵਾਲੇ ਨੂੰ ਜਦੋਂ ਦੱਸੀ ਦਾ ਕਿ ਇਨ੍ਹਾਂ ਚੀਜ਼ਾ ਨੂੰ ਦਾ ਧਿਆਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਰੱਖਣ ਬਣਾਉਣ ਦੇ ਟਾਈਮ ਤਾਂ ਹੀ ਤੁਹਾਡਾ ਜਿਹੜਾ ਪਕਵਾਨ ਹੈ ਉਹ ਅੱਛਾ ਬਣ ਸਕੇਗਾ